ਮੈਂ ਆਪਣੀ ਆਵਾਜ਼ ਨੂੰ ਨਿਖਾਰਨ ਲਈ ਬਹੁਤ ਅਭਿਆਸ ਕਰਦੀ ਹਾਂ ਮੈਂ ਗਰਮ ਪਾਣੀ ਦੇ ਗਰਾਰੇ ਕਰਦੀ ਹਾਂ ਤਾਂ ਜੋ ਗਲਾ ਸਾਫ਼ ਰਹੇ ਮੈਂ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਦੀ ਹਾਂ ਮੈਂ ਸਵੇਰੇ ਸ਼ਾਮ ਘੱਟੋ ਘੱਟ ਦੋ ਦੋ ਘੰਟੇ ਅਭਿਆਸ ਕਰਦੀ ਹਾਂ ਤਾਂ ਜੋ ਮੈਂ ਆਪਣੀ ਆਵਾਜ਼ ਨੂੰ ਵਧੀਆ ਕਰ ਸਕਾਂ ਅਤੇ ਲੋਕ ਮੇਰੀ ਆਵਾਜ਼ ਨੂੰ ਪਸੰਦ ਕਰਨ